ਮੈਂ ਮਾਨਸਾ ਦੀ ਰਹਿਣ ਵਾਲੀ ਹਾਂ ਮੈਂ ਬਰਨਾਲੇ ਦੇ ਰੈਸਟੋਰੈਂਟ 'ਚ ਪੰਜਾਹ ਬੰਦਿਆਂ ਦਾ ਖਾਣਾ ਬੁੱਕ ਕੀਤਾ ਸੀ ਜਿਸ ਕਰਕੇ ਮੇਰੇ ਪਾਰਟੀ ਦਾ ਟਾਈਮ ਛੇਤੀ ਹੋ ਗਿਆ ਅਤੇ ਮੈਂ ਨੇੜੇ ਦੇ ਬੰਸੀ ਦੇ ਢਾਬੇ ਤੋਂ ਖਾਣਾ ਮੰਗਾਉਂਦੀ ਹਾਂ ਖਾਣਾ ਰੈਜ ਹੋਣਾ ਚਾਹੀਦਾ ਹੈ ਕ ਪਨੀਰ ਦੀ ਸਬਜ਼ੀ ਅਤੇ ਸੁੱਕੀ ਸਬਜ਼ੀ ਵੀ ਹੋਣੀ ਚਾਹੀਦੀ ਹੈ ਅਤੇ ਜਿਸ ਦਾ ਪਤਾ ਪਟੇਲ ਨਗਰ ਗਲੀ ਨੰਬਰ ਚਾਰ ਹੈ ਅਤੇ ਖਾਣਾ ਵੈੱਜ ਹੋਣਾ ਚਾਹੀਦਾ ਹੈ ਜਿਸ ਕਰਕੇ ਮੈਂ ਪਤਾ ਅਡਰੈਸ ਲਿਖਾਉਂਦੀ ਹਾਂ ਅਤੇ ਇਹ ਖਾਣਾ ਬਹੁਤ ਵਧੀਆ ਹੋਣਾ ਚਾਹੀਦਾ ਹੈ